ਸਾਡੇ ਪਿੰਡਾਂ ਵਿੱਚ ਵਿਆਹਾਂ ਦੇ ਪ੍ਰਬੰਧ ਅੱਜ ਕੱਲ੍ਹ ਬੱਚਿਆਂ ਦੀ ਆਪਦੀ ਪਸੰਦ ਦੇ ਹੀ ਹੋ ਰਹੇ ਹਨ ਜ਼ਿਆਦਾਤਰ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਬੱਚੇ ਆਪਣੀ ਪਸੰਦ ਦੇ ਹੀ ਰਿਸ਼ਤੇ ਨੇ ਜਿਹੜੇ ਉਹ ਕਰਵਾ ਰਹੇ ਹਨ ਸੋ ਜਦੋਂ ਦੋ ਪਰਿਵਾਰਾਂ ਦੀ ਮੀਟਿੰਗ ਦੀ ਗੱਲ ਆਉਂਦੀ ਹੈ ਤਾਂ ਦੋ ਪਰਿਵਾਰਾਂ ਨੂੰ ਮਿਲਾਉਣ ਦਾ ਕੰਮ ਵੀ ਅੱਜ ਕੱਲ੍ਹ ਬੱਚੇ ਆਪ ਹੀ ਕਰ ਦਿੰਦੇ ਹਨ ਦੂਜੇ ਪਾਸੇ ਇੱਕ ਇਹ ਵੀ ਪਹਿਲੂ ਦੇਖਣ ਨੂੰ ਆਉਂਦਾ ਹੈ ਕਈ ਵਾਰ ਦੂਜਾ ਪਰਿਵਾਰ ਹੈ ਉਹ ਵਿਦੇਸ਼ ਦੇ ਵਿੱਚ ਹੁੰਦਾ ਹੈ ਤਾਂ ਉਹਨਾਂ ਦੀ ਮੁਲਾਕਾਤ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਵੀਡੀਓ ਕਾਲ ਦੇ ਰਾਹੀਂ ਕਰ ਦਿੱਤੀ ਜਾਂਦੀ ਹੈ ਇਹਨਾਂ ਮੀਟਿੰਗਸ ਦੇ ਵਿੱਚ ਜ਼ਿਆਦਾਤਰ ਅੱਜ ਕੱਲ੍ਹ ਕੁਛ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ ਕਿਉਂਕਿ ਬੱਚੇ ਪਹਿਲਾਂ ਹੀ ਇੱਕ ਦੂਜੇ ਦੇ ਨਾਲ਼ ਜਾਣੂ ਹੁੰਦੇ ਹਨ ਸੋ ਇਹਨਾਂ ਮੀਟਿੰਗਾਂ ਦੇ ਵਿੱਚ ਵਿਆਹ ਕਿਵੇਂ ਕੀਤਾ ਜਾਵੇਗਾ ਕਿਸ ਦਿਨ ਕੀਤਾ ਜਾਵੇਗਾ ਪੈਲਸ ਦੇ ਵਿੱਚ ਕੀ ਕੁਛ ਹੋਵੇਗਾ ਇਹੀ ਸਭ ਚੀਜ਼ਾਂ ਨੇ ਜਿਹੜੀਆਂ ਇਹੀ ਸਭ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਹਨ